ਹੈਲੋ ਸਤਿ ਸ਼੍ਰੀ ਅਕਾਲ ਜੀ ਰੰਜਨ ਗ੍ਰੋ ਗ੍ਰੋਸਰੀ ਸ਼ੋਪ ਤੋਂ ਬੋਲਦੇ ਜੀ ਕੱਲ੍ਹ ਮੈਂ ਤੁਹਾਡੇ ਕੋਲ ਸਮਾਨ ਲੈ ਕੇ ਗਿਆ ਰਾਸ਼ਨ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਲੈ ਕੇ ਗ੍ਰੋ ਤੁਹਾਡੇ ਕੋਲ ਸਮਾਨ ਉਹ 'ਚ ਜਿਹੜੀ ਤੁਹਾਡੀ ਸੂਜੀ ਤੀ ਉਹ ਖਰਾਬ ਨਿਕਲਿਆ ਵਿੱਚ ਹੋਰ ਵੀ ਸਮਾਨ ਐਕਸਪਾਇਰ ਤੇ ਸੂਜੀ 'ਚ ਕੀੜੇ ਕੂੜੇ ਲੱਗੇ ਵੇ ਤੇ ਹਾਂਜੀ ਉਹ ਵਾਪਸ ਕਰਨੇ ਤੇ ਮੈਂ ਮੈਗੀ ਵੀ ਲੈ ਗਿਆ ਤਾ ਮੈਗੀ ਵਿੱਚ ਖਰਾਬ ਨਿਕਲ ਗਈ ਹਾਂਜੀ ਵਿੱਚ ਕਈ ਸਮਾਨ ਐਕਸਪਾਇਰ ਵੀ ਆਏ ਵੇ ਸਾਰਾ ਸਮਾਨ ਨਹੀਂ ਵਿੱਚ ਸਮਾਨ ਆਏ ਵੇ ਚਾਰ ਪੰਜ ਸਮਾਨ ਹਾਂਜੀ ਮੇਰਾ ਕਹਿਣ ਦਾ ਮਤਲਬ ਇਹ ਕਿ ਮੈਂ ਵਾਪਸ ਕਰਨਾ ਜੀ ਹੁਣ

ਹਾਂਜੀ ਹਾਂਜੀ ਮੈਂ ਲਿਖਵਾ ਦਿੰਦਾ ਤੁਹਾਨੂੰ ਲਿਖੋ ਪਹਿ ਪਹਿਲਾਂ ਤਾਂ ਜੀ ਸੂਜੀ ਹੈ ਜੀ ਜਿਹੜੀ ਤੁੁਹਾਡੀ ਲੈ ਗਿਆ ਤਾ ਮੈਂ ਸੂਜੀ ਤੋਂ ਬਾਅਦ ਮੈਗੀ ਹੈ ਜੀ ਬੜੇ ਵਾਲੇ ਹੈ ਜੀ ਬੜੇ ਵਾਲੇ ਹਾਂਜੀ ਹੈਲੋ ਹਾਂਜੀ ਹਾਂਜੀ ਪੈਕਟ ਤਾਂ ਖੋਲ੍ਹ ਕੇ ਦੇਖਿਆ ਤਾ ਜੀ ਪੈਕਟ ਤਾਂ ਤਿੰਨ ਲੈ ਕੇ ਗਿਆ ਤਾ ਜੀ ਮੈਂ ਕਿੱਦਾਂ ਕਹਿੰਦੇ ਇੱਕੋ ਕਰਿਆ ਤਾ ਜੀ ਚੈੱਕ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਕਦੋਂ ਆਵਾਂ ਜੀ ਫਿਰ ਤੁਹਾਡੇ ਕੋਲ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਓਕੇ